ਸਤਿ ਸ਼੍ਰੀ ਅਕਾਲ ਮੈਡਮ ਜੀ ਮੇਰਾ ਨਾਮ ਆਰੁਸ਼ੀ ਹੈ ਮੈਂ ਆਪਣੇ ਐਨ ਪੀ ਐਸ ਖਾਤੇ ਵਿੱਚ ਲੋਗਇਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਂ ਆਪਣਾ ਪਾਸਵਰਡ ਭੁੱਲ ਚੁੱਕੀ ਹਾਂ ਇਸ ਕਰਕੇ ਮੈਂ ਆਪਣੇ ਐਨ ਪੀ ਐਸ ਖਾਤੇ ਵਿੱਚ ਲੋਗਇਨ ਨਹੀਂ ਕਰ ਪਾ ਰਹੀ ਹਾਂ ਕਿਰਪਾ ਕਰਕੇ ਮੈਨੂੰ ਥੋੜ੍ਹੀ ਜਾਣਕਾਰੀ ਪ੍ਰਦਾਨ ਕਰੋ ਤਾਂ ਕਿ ਮੈਂ ਜਲਦ ਤੋਂ ਜਲਦ ਆਪਣੇ ਖਾਤੇ ਵਿੱਚ ਲੋਗਇਨ ਕਰ ਸਕਾਂ ਮੈਂ ਮੈਂ ਸਵੇਰ ਤੋਂ ਲੱਗੀ ਹੋਈ ਹਾਂ ਆਪਣੇ ਖਾਤੇ ਵਿੱਚ ਲੋਗਇਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜਿਸ ਕਰਕੇ ਹੁਣ ਉਹ ਬੰਦ ਹੋ ਚੁੱਕਾ ਹੈ ਮੈਨੂੰ ਪੈਸਿਆਂ ਦੇ ਕਾਫੀ ਸਖਤ ਜ਼ਰੂਰਤ ਹੈ ਕਿਉਂਕਿ ਮੇਰੇ ਘਰ ਕੋਈ ਬਿਮਾਰ ਹੈ ਪਰ ਮੈਂ ਜਿੱਦਾਂ ਕਿ ਪਾਸਵਰਡ ਭੁੱਲ ਚੁੱਕੀ ਹਾਂ ਮੇਰੇ ਤੋਂ ਲੋਗਿਨ ਨਹੀਂ ਹੋ ਪਾ ਰਿਹਾ ਤੁਸੀਂ ਕਿਰਪਾ ਕਰਕੇ ਜਾਂ ਤਾਂ ਮੇਰਾ ਪਾਸਵਰਡ ਰੀਸੈਟ ਕਰਵਾ ਦਿਓ ਜਾਂ ਕੋਈ ਹੋਰ ਜਾਣਕਾਰੀ ਦਓ ਜੇ ਤੁਹਾਨੂੰ ਕੋਈ ਪੇਪਰ ਤਸਵੀਰ ਜੋ ਵੀ ਡਾਕੂਮੈਂਟਸ ਮੇਰੇ ਸਿਗਨੇਚਰ ਵਗੈਰਾ ਦੀ ਲੋੜ ਹੈ ਮੈਨੂੰ ਦੱਸੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾਂਗੀ ਬਟ ਮੈਨੂੰ ਇਸ ਬਾਰੇ ਪਲੀਜ਼ ਜਲਦ ਤੋਂ ਜਲਦ ਥੋੜ੍ਹੀ ਜਾਣਕਾਰੀ ਪ੍ਰਦਾਨ ਕਰੋ ਤਾਂ ਕਿ ਮੈਂ ਆਪਣੇ ਐਨ ਪੀ ਐਸ ਖਾਤੇ ਵਿੱਚ ਲੋਗਇਨ ਕਰ ਸਕਾਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ